ਮੈਨੂੰ ਲੋਕ ਗੀਤ ਸੁਣਨੇ ਬਹੁਤ ਪਸੰਦ ਹਨ ਜਿਵੇਂ ਕਿ ਸਤਿੰਦਰ ਸਰਤਾਜ ਦੇ ਜਿਹੜਾ ਗਾਉਣ ਦਾ ਲਹਿਜਾ ਹੈ ਉਹ ਬਹੁਤ ਹੀ ਸੁਚੱਜਾ ਅਤੇ ਇੱਕ ਨਵੀਨ ਪ੍ਰਣਾਲੀ ਨੂੰ ਵੀ ਦਰਸਾਉਂਦਾ ਜਿਵੇਂ ਕਿ ਸਤਿੰਦਰ ਸਰਤਾਜ ਦੇ ਕੁਝ ਗਾਣੇ ਸੱਜਣ ਰਾਜ਼ੀ ਹੋ ਜਾਵੇ ਅਤੇ ਅੱਜ ਕੱਲ੍ਹ ਜਿਹੜਾ ਪ੍ਰਚਲਿਤ ਗਾਣਾ ਹੈ ਮਤਵਾਲੀਏ ਨਸ਼ੀਲੇ ਨੈਣਾ ਵਾਲੀਏ ਇਹ ਕੁਝ ਸੌਂਗ ਨੇ ਜਿਹੜੇ ਸਤਿੰਦਰ ਸਰਤਾਜ ਦੇ ਜਿਹੜੇ ਮੈਨੂੰ ਖ਼ਾਸ ਕਰਕੇ ਪਸੰਦ ਨੇ ਜਿਹਦੇ ਸਤਰਾਂ ਮੈਂ ਕੁਝ ਤੁਹਾਨੂੰ ਸੁਣਾ ਸਕਦਾ ਹੈ ਜਿਵੇਂ ਕਿ ਸ ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ ਜਿਵੇਂ ਹੁੰਦੀ ਮੋਰਨੀ ਦੀ ਹੂਕ ਸੋਣਿਆ ਦੂਰ ਕਿਤੇ ਜੰਗਲਾਂ 'ਚ ਨੱਚਦੀ ਫਿਰੇ ਸ਼ਹਿਰ ਤੱਕ ਸੁਣ ਜਾਂਦੀ ਹੂਕ ਸੋਹਣਿਆ ਅਤੇ ਦੂਜਾ ਸੌਂਗ ਜਿਹੜਾ ਮੈਂ ਦੱਸਿਆ ਸੀ ਮਤਵਾਲੀਏ ਨਸ਼ੀਲੇ ਨੈਣਾ ਵਾਲੀਏ ਨੀ ਇੱਕ ਮੈਨੂੰ ਗੱਲ ਦੱਸ ਜਾ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ ਨੀ ਇੱਕ ਵਾਰੀ ਹੋਰ ਹੱਸ ਜਾ ਤਾਂ ਇੱਦਾਂ ਦੇ ਜਿਹੜੇ ਸੌਂਗ ਨੇ ਉਹ ਮੈਨੂੰ ਜਿਹੜੇ ਗਾਣੇ ਨੇ ਉਹ ਮੈਨੂੰ ਬਹੁਤ ਪ੍ਰਭਾਵਿਤ ਕਰਦੇ ਨੇ ਅਤੇ ਮੈਨੂੰ ਕਾਫੀ ਉਤਸ਼ਾਹਿਤ ਵੀ ਕਰਦੇ ਆਂ ਸੁਣਨ ਦੇ ਵਿੱਚ ਕਿਉਂਕਿ ਇਹਨਾਂ ਦਾ ਸੁਣਨ ਦਾ ਜਿਹੜਾ ਆਨੰਦ ਹੈ ਉਹ ਆਪਣੇ ਆਪਣੀ ਮਾਨਸਿਕ ਸਥਿਤੀ ਨੂੰ ਵੀ ਇੱਕ ਤਰ੍ਹਾਂ ਤੋਂ ਟਿਕਾਵ ਦੇ ਵਿੱਚ ਰੱਖਦਾ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਗਾਣੇ ਨੇ ਉਹ ਮੈਂ ਕਾਫੀ ਸੁਣਨੇ ਪਸੰਦ ਕਰਦਾ